ਉਂਝ ਤਾਂ ਮੈਂ ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਨਾਵਲ ਪੜ੍ਹੇ ਆ ਜੋ ਸਮਾਜ ਰਿਸ਼ਤੇ ਅਤੇ ਇਤਿਹਾਸ ਨੂੰ ਉਭਾਰਦੇ ਹੈ ਪਰ ਮੈਨੂੰ ਸਾਰਿਆਂ 'ਚੋਂ ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਬਹੁਤ ਵਧੀਆ ਲੱਗਿਆ ਜੋ ਪਾਕਿਸਤਾਨ ਵੰਡ ਦੀ ਮਤਲਬ ਜੋ ਕਹਾਣੀ ਸੁਣਾਉਂਦਾ ਉਹਦੇ ਵਿੱਚ ਲੋਕਾਂ ਦੇ ਜੋ ਘਰ ਉਜੜੇ ਪਰਿਵਾਰ ਉਜੜੇ ਬਹੁਤ ਜਿਵੇਂ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਉਹਦੀਆਂ ਸਾਰੀਆਂ ਸਮੱਸਿਆਵਾਂ ਨੂੰ ਮਤਲਬ ਵੀ ਉਹਦੇ 'ਚ ਦਰਸਾਇਆ ਗਿਆ ਇਸ ਕਰਕੇ ਉਹ ਮੇਰੇ ਬਹੁਤ ਨੂੰ ਦਿਲ ਨੂੰ ਛੂਹ ਗਿਆ